ਖੇਡਾਂ ਸਾਡੇ ਜੀਵਨ ਵਿੱਚ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆ ਹਨ ਕਿਉਕਿ ਖੇਡਾਂ ਨਾਲ ਨੌਜਵਾਨ ਜਿਹੜੇ ਸਾਡੇ ਨੇ ਉਹ ਕਾਫ਼ੀ ਬਿਜੀ ਰਹਿਣਗੇ ਉਹਨਾਂ ਦੇ ਸਰੀਰ ਵੱਧਦੇ ਫੁੱਲਦੇ ਰਹਿਣਗੇ ਅਤੇ ਨਸ਼ਿਆਂ ਤੋਂ ਦੂਰ ਰਹਿਣਗੇ ਪਿੰਡਾਂ ਦੀਆ ਖੇਡਾਂ ਬਹੁਤ ਹੀ ਵਧੀਆ ਹੁੰਦੀਆ ਹਨ ਜਿਵੇਂ ਖੋ ਖੋ ਕਬੱਡੀ ਰੇਸ ਕੁਸ਼ਤੀ ਇਹ ਕਾਫ਼ੀ ਤਰ੍ਹਾ ਦੇ ਮੁਕਾਬਲੇ ਹੁੰਦੇ ਹਨ ਜੋ ਕਿ ਲੋਕ ਚੰਗੀ ਤਰ੍ਹਾ ਖੇਡਦੇ ਹਨ ਅਤੇ ਜਿਹਦੇ ਨਾਲ ਸਰੀਰ ਵਿੱਚ ਜਾਨ ਆਉਂਦੀ ਹੈ ਸਾਡੇ ਪਿੰਡਾਂ ਵਿੱਚ ਜਦੋਂ ਵ ਵਿਸਾਖੀ ਦੇ ਮੌਕੇ 'ਤੇ ਕਬੱਡੀ ਦਾ ਮੈਚ ਹੁੰਦਾ ਹੈ ਦੂਰੋਂ ਦੂਰੋਂ ਟੀਮਾਂ ਆਉਂਦੀਆ ਹਨ ਉਹਨਾਂ ਵਿੱਚ ਕਬੱਡੀ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਜੋ ਟੀਮ ਜਿੱਤ ਜਾਂਦੀ ਹੈ ਉਸ ਨੂੰ ਬਹੁਤ ਸੋਹਣੇ ਇਨਾਮ ਦਿੱਤੇ ਜਾਂਦੇ ਹਨ ਧੰਨਵਾਦ